ਮੋਹਾਲੀ ਜ਼ਿਲ੍ਹੇ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮਹੱਤਵਪੂਰਨ ਸਥਾਨ ਮਿਲ ਜਾਂਦੇ ਹਨ ਜੋ ਕਿ ਸੈਲਾਨੀਆਂ ਦੀ ਖਿੱਚ ਦਾ ਕਾਰਨ ਬਣਦੇ ਨੇ ਅਤੇ ਜਿਸ ਕਾਰਨ ਉਹ ਇੱਥੇ ਇਸ ਜਗ੍ਹਾ ਨੂੰ ਘੁੰਮਣ ਵਾਸਤੇ ਜ਼ਰੂਰ ਆਉਂਦੇ ਨੇ ਅਤੇ ਇਹ ਪਹਿਲੀ ਗੱਲ ਤਾਂ ਇਹ ਜਗ੍ਹਾ ਚੰਡੀਗੜ੍ਹ ਦੇ ਨਾਲ਼ ਪੈ ਜਾਂਦੀ ਹੈ ਅਤੇ ਚੰਡੀਗੜ੍ਹ ਦੇ ਨਾਲ ਹੋਣ ਕਰਕੇ ਲੋਕ ਇੱਥੇ ਜ਼ਰੂਰ ਵਿਜ਼ਿਟ ਕਰਦੇ ਨੇ ਇੱਥੇ ਬਹੁਤ ਸਾਰੀਆਂ ਪਲੇਸਿਸ ਨੇ ਘੁੰਮਣ ਨੂੰ ਜਿਵੇਂ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵੀ ਆਰ ਪੰਜਾਬ ਮੋਲ ਫਤਿਹਪੁਰ 'ਚ ਮਾਤਾ ਮਨਸਾ ਦੇਵੀ ਟੈਂਪਲ ਸਿਲਵੀ ਪਾਰਕ ਅਤੇ ਇੱਥੋਂ ਦੀਆਂ ਮਾਰਕਿਟਸ ਅਤੇ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਅਤੇ ਆਹ ਜਿਹੜੀਆਂ ਚੀਜ਼ਾਂ ਨੇ ਇਹ ਇਸ ਚੀਜ਼ ਨੂੰ ਬਹੁਤ ਜ਼ਿਆਦਾ ਆਕਰਸ਼ਿਤ ਬਣਾਉਂਦੀਆਂ ਨੇ ਅਤੇ ਇੱਥੋਂ ਦੂਰੋਂ ਦੂਰੋਂ ਲੋਕ ਇਸ ਚੀਜ਼ ਨੂੰ ਵਿਜ਼ਿਟ ਕਰਦੇ ਨੇ ਅਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਬੰਦਾ ਸਿੰਘ ਬਹਾਦਰ ਦਾ ਜਿਹੜਾ ਮੈਮੋਰੀਅਲ ਪੁਆਇੰਟ ਆ ਉਹ ਇਸ ਚੀਜ਼ ਦੀ ਖਿੱਚ ਦਾ ਕਾਰਨ ਬਣਦਾ ਆ ਅਤੇ ਜੇ ਆਪਾਂ ਮੋਹਾਲੀ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਨਾਮ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਫੇਸ਼ੀਅਲ ਨਾਮ ਆ ਸਾਹਿਬਜਾਦਾ ਅਜੀਤ ਸਿੰਘ ਨਗਰ ਆ ਅਤੇ ਇਹੀ ਇਸ ਜ਼ਿਲ੍ਹੇ ਦੀ ਬਹੁਤ ਜ਼ਿਆਦਾ ਵੱਡੀ ਗੱਲ ਆ ਅਤੇ ਇਹ ਤੋਂ ਇਲਾਵਾ ਇੱਥੇ ਸਾਨੂੰ ਕ੍ਰਿਕਟ ਦਾ ਸਟੇਡੀਅਮ ਮਿਲ ਜਾਂਦਾ ਇਆ ਅਤੇ ਜਿਹੜੇ ਕ੍ਰਿਕਟ ਦੇ ਸ਼ੌਕੀਨ ਲੋਕ ਨੇ ਉਹ ਇੱਥੇ ਘੁੰਮਣ ਆਉਂਦੇ ਨੇ ਮਤਲਬ ਆਪਣਾ ਕ੍ਰਿਕਟ ਦੇ ਜਿਹੜੇ ਸ਼ੋਅ ਨੇ ਉਹ ਦੇਖਣ ਆਉਂਦੇ ਨੇ ਤੇ ਇਹ ਤੋਂ ਇਲਾਵਾ ਆਪਾਂ ਨੂੰ ਹੋਰ ਵੀ ਬਹੁਤ ਸਾਰੀਆਂ ਪਲੇਸਿਸ ਮਿਲ ਸਕਦੀਆਂ ਨੇ ਤਾਂ ਬਹੁਤ ਸਾਰੀਆਂ ਪਲੇਸਿਸ ਹੈਗੀਆਂ ਨੇ ਜਿੱਥੇ ਜਿਹੜੇ ਸੈਲਾਨੀ ਆ ਉਹ ਘੁੰਮਣ ਆਉਂਦੇ ਨੇ